ਹਾਂਜੀ ਕੋਈ ਉਹ ਇਸੇ ਏਰੀਏ ਦੇ ਵਿੱਚ ਆਟੋ ਵਗੈਰਾ ਉਪਲਬਧ ਹੋ ਸਕਦੀ ਹੈ ਜੀ ਅਤੇ ਥੋੜ੍ਹਾ ਮੈਂ ਦੇਰ ਰਾਤ ਨੂੰ ਦੇਰ ਨੂੰ ਜਾਣਾ ਇੱਥੇ ਨੇੜੇ ਕੋਈ ਜਿਵੇਂ ਬਲਾਡੇ ਤੋਂ ਮਾਨਸਾ ਤੱਕ ਜਾਣ ਵਾਲੀ ਕੋਈ ਬੱਸ ਟ੍ਰੇਨ ਜਾਂ ਕੋਈ ਫਲਾਈਟ ਤਾਂ ਨਹੀਂ ਪਰ ਬਸਸ ਟਰੇਨ ਵਗੈਰਾ ਮਿਲ ਸਕਦੀ ਹੈ ਤਾਂ ਪਲੀਜ਼ ਕਿਉਂਕਿ ਮੈਨੂੰ ਰਾਤ ਨੂੰ ਪਹੁੰਚਣਾ ਹੈ ਉੱਥੇ ਮੈਨੂੰ ਇੱਕ ਕੈਬ ਜਾਂ ਕੋਈ ਆਟੋ ਉਪਲਬਧ ਹੋਜੇ ਗਾਹਾਂ ਬਲਾਡੇ ਤੋਂ ਗਾਹਾ ਜਾਣ ਲਈ ਬਲਾਡੇ ਤੋਂ ਗਾਹਾਂ ਦੋ ਕਿਲੋਮੀਟਰ ਅੱਗੇ ਜਾਣਾ ਮੈਂ ਅਤੇ ਸਮਾਂ ਜਿਹੜਾ ਮੇਰਾ ਵੀ ਹੋ ਸਕਦਾ ਹੈ ਮੈਨੂੰ ਸ਼ਾਮ ਹੋ ਜੇ ਰਾਤ ਨੂੰ ਸ਼ਾਮ ਨੂੰ ਛੇ ਸਾਢੇ ਛੇ ਸੱਤ ਵੀ ਵੱਜ ਸਕਦੇ ਹੈ ਇੰਨੇ ਚਿਰ 'ਚ ਮੈਨੂੰ ਕੋਈ ਇਹ ਫੈਸਿਲਿਟੀ ਉਪਲਬਧ ਹੋ ਸਕਦੀ ਹੈ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸੋ ਕਿਉਂਕਿ ਮੈਂ ਇਸ ਏਰੀਏ 'ਚ ਨਵੀਂ ਆਈ ਹਾਂ ਮੈਨੂੰ ਇਹਦੇ ਬਾਰੇ ਕੁਛ ਵੀ ਪਤਾ ਨਹੀਂ ਹੈਗਾ ਮੇਰਾ ਇੱਧਰ ਪੇਪਰ ਸੀ ਅਤੇ ਮੈਂ ਉਹ ਪੇਪਰ ਦੇਣ ਆਉਣਾ ਹੈ ਇਸ ਕਰਕੇ ਮੈਂ ਪਹਿਲਾਂ ਇਹਦੀ ਜਾਣਕਾਰੀ ਲੈਣਾ ਚਾਹੁੰਦੀ ਏ ਇਸ ਏਰੀਏ ਦੀ ਵੀ ਮੈਨੂੰ ਕੈਬ ਜਾਂ ਕੋਈ ਆਟੋ ਟਾਈਮ 'ਤੇ ਮਿਲ ਸਕਦਾ ਅਤੇ ਉਹ ਤੋਂ ਬਾਅਦ ਬੱਸ ਟਰੇਨ ਦਾ ਕੋਈ ਓਧਰ ਟਾਈਮ ਹੈਗਾ ਤਾਂ ਕਿਰਪਾ ਕਰਕੇ ਜ਼ਰੂਰ ਦੱਸੋ